ਚੌਵੀ ਅਗਸਤ ਦੋ ਹਜ਼ਾਰ ਤਿੰਨ ਦਸ ਜਨਵਰੀ ਉੱਨੀ ਸੌ ਛਿਆਨਵੇਂ ਸੋਲ੍ਹਾਂ ਜੁਲਾਈ ਦੋ ਹਜ਼ਾਰ ਦੋ ਸਤਾਰਾਂ ਮਾਰਚ ਦੋ ਹਜ਼ਾਰ ਬਾਈ ਉੱਨੀ ਜੁਲਾਈ ਦੋ ਹਜ਼ਾਰ ਬਾਈ